ਮੈਂ ਨਵੀਨਤਮ ਤਕਨੀਕ ਰੋਜ਼ਾਨਾ ਅਤੇ ਨਵੀਨਤਾਵਾਂ ਨਾਲ ਜੁੜੇ ਰਹਿਣ ਵਿੱਚ ਵੱਖ ਵੱਖ ਤਰੀਕਿਆਂ ਨਾਲ ਪਸੰਦ ਕਰਦਾ ਹਾਂ ਇਸ ਵਿੱਚ ਹੇਠ ਲਿਖੇ ਤਰੀਕੇ ਸ਼ਾਮਲ ਹਨ ਓਨਲਾਈਨ ਸਰੋਤਾਂ ਦੀ ਵਰਤੋਂ ਲਈ ਮੈਂ ਓਨਲਾਈਨ ਰਿਸਰਚ ਪਲੇ ਪਲੇਟਫਾਰਮ ਜਿਵੇਂ ਕਿ ਉਪੋਗੀ ਟੈਕਨੀਕਲ ਜਰਨਲ ਅਤੇ ਵੈਲੋਗੀ ਦੇ ਨਾਲ ਨਿਯਮਤ ਤੌਰ 'ਤੇ ਦੇਖਦਾ ਹਾਂ ਜਿੱਥੇ ਨਵੇਂ ਤ੍ਰੀ ਤਕਨੀਕੀ ਵਿਕਾਸ ਇਨੋਵੇਸ਼ਨ ਅਤੇ ਖੋਜਾਂ ਦੀ ਜਾਣਕਾਰੀ ਹੈ ਮੋਟੀਵੇਸ਼ਨ ਆਰਟੀਫਿਸ਼ਅਲਸ ਇੰਟੈਲੀਜੈਂਸੀ ਮੋਟੀਵੇਸ਼ਨਸ ਅਤੇ ਭਵਿੱਖ ਦੀ ਯਾਤਰਾ ਦੇ ਆਰਟੀਫਿਸ਼ਅਲਸ ਇੰਟੈਲੀਜੈਂਸੀ ਦੇ ਮੋੜ ਵਿੱਚ ਨਵੇਂ ਨਵੇਂ ਵਿਕਾਸ ਉਤਪਾਦਕਾਂ ਨੂੰ ਸਮਝਣ ਦਾ ਬਹੁਤ ਦਿਲਚਸਪ ਹੁੰਦਾ ਹੈ ਇਸ ਤਰੀਕੇ ਦੇ ਖੇਤਰਾਂ ਵਿੱਚ ਨਵੇਂ ਸਮਾਰਟ ਯੰਤਰ ਅਤੇ ਪ੍ਰੋਜੈਕਟਾਂ ਦੇ ਨਾਲ ਜੁੜਿਆਂ ਰਹਿਣਾ ਜ਼ਰੂਰੀ ਹੈ ਏ ਆਈ ਇੰਜੀਨੀਅਰਿੰਗ ਦੇ ਨਾਲ ਸਹਿਯੋਗ ਏ ਆਈ ਅਤੇ ਮਸ਼ੀਨੀ ਲਰਨਿੰਗ ਵਿੱਚ ਤਾਜ਼ਾ ਤਕਨੀਕੀ ਪ੍ਰਗਤੀ ਨਾਲ ਅਪਡੇਟ ਰਹਿਣ ਲਈ ਮੈਂ ਮਸ਼ਹੂਰ ਏ ਆਈ ਇੰਜੀਨੀਅਰ ਅਤੇ ਵਿਦਵਾਨਾਂ ਦੀ ਰਚਨਾਵਾਂ ਦੀ ਓਨਲਾਈਨ ਕੋਰਸਾਂ ਨੂੰ ਫੋਲੋ ਕਰਦਾ ਹਾਂ ਇਸ ਨਾਲ ਸਿੱਖਣ ਨੂੰ ਮਿਲਦਾ ਹੈ ਕਿ ਕਿਵੇਂ ਨਵੇਂ ਐਲ ਗੋਰੀਦਮ ਨਾਲ ਮੋਡਲ ਉਚਿਤ ਸਮੱਸਿਆਵਾਂ ਵਿੱਚ ਹੱਲ ਕਰ ਸਕਦੇ ਹਨ ਇਹ ਸਾਰੀਆਂ ਵੱਖ ਵੱਖ ਮਾਧਿਅਮਾਂ ਦੀ ਵਰਤੋਂ ਕਰਦੇ ਮੈਂ ਨਵੀਨਤਮ ਤਕਨੀਕ ਰੁਝਾਨ ਦੀ ਨਵੀਤਨਮ ਨਾਲ ਜੁੜਿਆ ਰਹਿੰਦਾ ਹਾਂ